ਸਤਿ ਸ਼੍ਰੀ ਅਕਾਲ ਜੀ ਮੈਂ ਰ ਹਰਮਨਪ੍ਰੀਤ ਗੱਲ ਕਰ ਰਹੀ ਹਾਂ ਮੈਂ ਇੰਸਟਾਗ੍ਰਾਮ 'ਤੇ ਤੁਹਾਡਾ ਪ੍ਰੋਡਕਟਸ ਦਾ ਪੇਜ ਦੇਖਿਆ ਸੀਗਾ ਅਤੇ ਜਿੱਥੋਂ ਮੈਂ ਇੱਕ ਓਵਨ ਰੀਪਲੇਸ ਔਰਡਰ ਕੀਤਾ ਸੀਗਾ ਐੱਲ ਜੀ ਕੰਪਨੀ ਦਾ ਅਤੇ ਜਿਹਦੀ ਪੈਕਿੰਗ ਵੀ ਮੈਨੂੰ ਬਹੁਤ ਵਧੀਆ ਮਿਲੀ ਅਤੇ ਬੈਸਟ ਕੁਆਲਿਟੀ ਦਾ ਸੀਗਾ ਅਤੇ ਉਹਦੀ ਜਿਹੜੀ ਪੈਕਿੰਗ ਸੀਗੀ ਬੜੀ ਹਾਰਡ ਸੀਗੀ ਅਤੇ ਓਵਨ ਨੂੰ ਕੋਈ ਸਕਰੈਚ ਵਗੈਰਾ ਕੁਛ ਵੀ ਨਹੀਂ ਆਇਆ ਬੜੀ ਗੁੱਡ ਕੰਡੀਸ਼ਨ 'ਚ ਮੈਨੂੰ ਮਿਲਿਆ ਅਤੇ ਮੈਂ ਜਿਹੜੇ ਕਲਰ ਦਾ ਕੀਤਾ ਸੀਗਾ ਲਾਈਕ ਬਲੈਕ ਐਂਡ ਸਿਲਵਰ ਕਲਰ ਦਾ ਮੈਨੂੰ ਉਸੀ ਕਲਰ 'ਚ ਹੀ ਮਿਲਿਆ ਬਲਕਿ ਜਿੱਦਾਂ ਦਾ ਮੈਂ ਫੋਟੋ 'ਚ ਦੇਖਿਆ ਸੀਗਾ ਉਹ ਤੋਂ ਕਿਤੇ ਦੁੱਗਣਾ ਬੈਸਟ ਮਿਲਿਆ ਹੈ ਮੈਨੂੰ ਅਤੇ ਜਿਹੜਾ ਇਹਦਾ ਗਲਾਸ ਆ ਫਰੰਟ ਗਲਾਸ ਆ ਓਵਨ ਦਾ ਉਹ ਵੀ ਬੜਾ ਵਧੀਆ ਕੁਆਲਿਟੀ ਦਾ ਆ ਉਹ ਇੱਦਾਂ ਟੁੱਟਣ ਵਾਲਾ ਨਹੀਂ ਹੈਗਾ ਜਲਦੀ ਜਲਦੀ ਅਤੇ ਮੇਰੇ ਘਰ 'ਚ ਵੈਸੇ ਵੀ ਬੱਚੇ ਰਹਿੰਦੇ ਹਨ ਤਾਂ ਕਿ ਉਹ ਤੋੜ ਨਾ ਸਕਣ ਉਹਨੂੰ ਅਤੇ ਜਿਹੜੇ ਤੁਸੀਂ ਇਹਦੇ ਨਾਲ ਮੈਨੂੰ ਯੂ ਯੂਟੀਲਾਈਜ਼ਿਜ਼ ਦਿੱਤੇ ਹਨ ਫੋਰ ਬਾਊਲ ਐਂਡ ਤਿੰਨ ਸਪੂਨ ਉਹ ਵੀ ਬੜੇ ਵਧੀਆ ਕੁਆਲਿਟੀ ਦੇ ਹਨ ਅਤੇ ਉਹ ਜਲਦੀ ਜਲਦੀ ਨਹੀਂ ਖਰਾਬ ਐਂਡ ਬ੍ਰੋਕਨ ਹੋਣ ਵਾਲੇ ਅਤੇ ਜਿਹੜੇ ਇਹਦਾ ਟਾਈਮਰ ਉਹ ਵੀ ਬੜਾ ਜਲ ਵਧੀਆ ਹੈ ਜੋ ਕਿ ਛੋਟੇ ਟਾਈਮ 'ਚ ਬੜਾ ਵਧੀਆ ਫੂਡ ਨੂੰ ਦੁਬਾਰਾ ਫਰੈਸ਼ ਕਰ ਦਿੰਦਾ ਆ ਅਤੇ ਗਰੀਲਰ ਵੀ ਬੜੇ ਘੈਂਟ ਨੇ ਇਹਦੀਆਂ ਜੋ ਕਿ ਬਹੁਤ ਜਲਦੀ ਗਰਮ ਹੋ ਕੇ ਜਲਦੀ ਜਲਦੀ ਜਿਹੜਾ ਫੂਡ ਦਾ ਉਹ ਆ ਬਣਾ ਦਿੰਦੀਆਂ ਨੇ ਅਤੇ ਸਭ ਤੋਂ ਬੈਸਟ ਗੱਲ ਮੈਨੂੰ ਇੱਕ ਲੱਗੀ ਜੋ ਕਿ ਉਹ ਤੁਸੀਂ ਮੈਨੂੰ ਟਵੰਟੀ ਪਰਸੈਂਟ ਡਿਸਕਾਊਂਟ ਦਿੱਤਾ ਹੈ ਨਾ ਜੋ ਕਿ ਜੈਨੂਅਨਲੀ ਕੋਈ ਵੀ ਨਹੀਂ ਦਿੰਦਾ ਇਹ ਚੀਜ਼ਾਂ ਕਿਉਂਕੀ ਮਾਰਜਨ ਹੀ ਬਹੁਤ ਘੱਟ ਹੁੰਦਾ ਆ ਅਤੇ ਮੈਂ ਇਹ ਚੀਜ਼ ਆਪਣੇ ਫਰੈਂਡਜ਼ ਨੂੰ ਦੱਸੀ ਅਤੇ ਉਹ ਸਾਰੇ ਬੜੇ ਹੈਰਾਨ ਹੋਏ ਕਿ ਤੈਨੂੰ ਐਨਾ ਵਧੀਆ ਓਵਨ ਅਤੇ ਬੜੇ ਸਸਤੇ ਪ੍ਰਾਈਸ 'ਚ ਮਿਲਿਆ ਅਤੇ ਮੈਂ ਆਪਣੇ ਫਰੈਂਡਜ਼ ਨੂੰ ਵੀ ਬੜਾ ਸੁਜੈਸਟ ਕੀਤਾ ਕਿ ਇਹ ਵੈੱਬਸਾਈਟ ਆ ਤੁਸੀਂ ਇੱਥੇ ਜਾ ਕੇ ਔਰਡਰ ਕਰੋ ਅਤੇ ਤੁਹਾਨੂੰ ਵੀ ਮੇ ਬੀ ਇਹ ਡਿਸਕਾਊਂਟ ਮਿਲੇ ਅਤੇ ਮੈਂ ਅੱਗੋਂ ਵੀ ਤੁਹਾਡੇ ਨਾਲ ਇਹ ਜਿਹੜੀ ਸ਼ੋਪਿੰਗ ਆ ਬੜੀ ਕੰਟੀਨਿਊ ਕਰਦੀ ਰਹਾਂਗੀ ਧੰਨਵਾਦ ਤੁਹਾਡਾ